ਵੈਸੇ ਤਾਂ ਸਾਰੀ ਪੰਜਾਬੀ ਭਾਸ਼ਾ ਹੀ ਮੇਰੀ ਮਨਪਸੰਦੀ ਦੀ ਭਾਸ਼ਾ ਹੈ ਮੈਨੂੰ ਇਸ ਦੇ ਸਾਰੇ ਸ਼ਬਦ ਬਹੁਤ ਵਧੀਆ ਲੱਗਦੇ ਹਨ ਪਰ ਕੁਝ ਵਾਕੰਸ਼ ਜੋ ਮੇਰਾ ਮਨਭਾਉਂਦੇ ਹਨ ਉਹਨਾਂ ਵਿੱਚ ਜਿਵੇਂ ਈਦ ਦਾ ਚੰਦ ਹੋਣਾ ਉਂਗਲਾਂ 'ਤੇ ਨਚਾਉਣਾ ਅਸਮਾਨ ਨੂੰ ਟਾਕੀਆ ਲਾਉਣਾ ਅੱਖਾਂ ਉੱਤੇ ਬਿਠਾਉਣਾ ਹੱਥ ਵਟਾਉਣਾ ਉੱਚਾ ਨੀਵਾਂ ਬੋਲਣਾ ਅੱਖਾਂ ਫੇਰ ਲੈਣੀਆ ਅੱਡੀਆਂ ਲੱਗਣਾ ਆਦਿ ਮੇਰੇ ਮਨਭਾਉਂਦੇ ਵਾਕੰਸ਼ ਹਨ ਕਿਉਂਕਿ ਅਸੀਂ ਇਹਨਾਂ ਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਹੀ ਬੋਲਦੇ ਹਾਂ ਜਦੋਂ ਕਿਸੇ ਨਾਲ ਕੋਈ ਗੱਲਬਾਤ ਜਾਂ ਅਸੀਂ ਟਿੱਚਰ ਕਰਦੇ ਹਾਂ ਜਾਂ ਕਿਸੇ ਨੂੰ ਹਾਸਾ ਮਖੌਲ ਕਰਦੇ ਹਾਂ ਜਾਂ ਕਿਸੇ ਨੂੰ ਕੁਝ ਵੀ ਬੋਲਦੇ ਹਾਂ ਤਾਂ ਉਹਨਾਂ ਵਿੱਚ ਇਹ ਵਾਕੰਸ਼ ਸ਼ਬਦ ਵੈਸੇ ਹੀ ਅਸੀਂ ਬੋਲ ਦਿੰਦੇ ਹਾਂ ਮੈਂ ਪੰਜਾਬੀ ਦਾ ਮੂਲ ਬੁਲਾ ਬੁਲਾਰਾ ਹੋਣ ਉੱਤੇ ਬਹੁਤ ਮਾਣ ਮਹਿਸੂਸ ਕਰਦਾਂ ਕਿਉਂਕਿ ਪੰਜਾਬੀ ਉਹ ਭਾਸ਼ਾ ਹੈ ਜੋ ਨਾ ਕਿ ਸਿਰਫ ਪੰਜਾਬ ਵਿੱਚ ਹੀ ਬੋਲੀ ਜਾਂਦੀ ਹੈ ਬਲਕਿ ਮੈਂ ਤਾਂ ਇਹ ਕਹਾਂਗਾ ਕਿ ਸਾਰੇ ਸੰਸਾਰ ਦੀ ਹਰਮਨ ਪਿਆਰੀ ਭਾਸ਼ਾ ਬਣਦੀ ਜਾ ਰਹੀ ਹੈ ਕਈ ਦੇਸ਼ ਤਾਂ ਅਜਿਹੇ ਵੀ ਹਨ ਜਿਹਨਾਂ ਵਿੱਚ ਇਹ ਉਹਨਾਂ ਦੀ ਆਪਣੀ ਭਾਸ਼ਾ ਤੋਂ ਬਾਜ ਬਾਅਦ ਦੂਜੀ ਤੀਜੀ ਭਾਸ਼ਾ ਵੀ ਬਣ ਗਈ ਹੈ ਜਿੱਥੇ ਕਿਤੇ ਵੀ ਮੈਂ ਜਾਂਦਾ ਹਾਂ ਮੈਨੂੰ ਬਹੁਤ ਹੀ ਮਾਣ ਸਤਿਕਾਰ ਮਿਲਦਾ ਹੈ ਜੋ ਸਿਰਫ ਪੰਜਾਬੀ ਭਾਸ਼ਾ ਕਰਕੇ ਹੈ ਇਹ ਭਾਸ਼ਾ ਸਾਡੇ ਗੁਰੂਆਂ ਪੀਰਾਂ ਦੀ ਬੋਲੀ ਹੈ ਸੂਫੀ ਸੰਤਾਂ ਦੀ ਬੋਲੀ ਹੈ